ਪੰਜਾਬ ਵਿੱਚ ਕਈ ਜ਼ਿਲ੍ਹੇ ਹਨ ਜੋ ਕਿ ਮੰਨੋਰੰਜਨ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਜਿਵੇ ਕਿ ਮੋਹਾਲੀ ਅੰਮ੍ਰਿਤਸਰ ਜਲੰਧਰ ਫਤਿਹਗੜ੍ਹ ਸਾਹਿਬ ਰੋਪੜ ਅਤੇ ਚੰਡੀਗੜ੍ਹ ਮੋਹਾਲੀ ਵਿੱਚ ਕ੍ਰਿਕਟ ਸਟੇਡੀਅਮ ਹੈ ਇੱਥੇ ਬਹੁਤ ਸਾਰੇ ਆਈ ਪੀ ਐੱਲ ਅਤੇ ਇੰਟਰਨੈਸ਼ਨਲ ਪੱਧਰ ਦੇ ਕ੍ਰਿਕਟ ਮੈਚ ਹੁੰਦੇ ਹਨ ਇਨ੍ਹਾਂ ਕ੍ਰਿਕਟ ਮੁਕਾਬਲਿਆਂ ਨੂੰ ਵੇਖਣ ਲਈ ਹਜ਼ਾਰਾਂ ਲੋਕ ਆਉਂਦੇ ਹਨ ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ ਜਲ੍ਹਿਆਂਵਾਲਾ ਬਾਗ ਅਤੇ ਬਾਘਾ ਬੋਡਰ ਹੈ ਜਲੰਧਰ ਜ਼ਿਲ੍ਹੇ ਵਿੱਚ ਸਾਇੰਸ ਸਿਟੀ ਹੈ ਜੋ ਕਿ ਨੋਲੇਜ ਦਾ ਸ੍ਰੋਤ ਹੈ ਹਵੇਲੀ ਵੀ ਜਲੰਧਰ ਕੋਲ ਹੀ ਆਉਂਦੀ ਹੈ ਜਿੱਥੇ ਲੋਕ ਬੜੀ ਵੱਡੀ ਗਿਣਤੀ ਵਿੱਚ ਪੰਜਾਬੀ ਖਾਣਾ ਪਸੰਦ ਕਰਦੇ ਹਨ ਫਤਿਹਗੜ੍ਹ ਸਾਹਿਬ ਗੁਰਦੁਆਰਿਆਂ ਦੀ ਧਰਤੀ ਹੈ ਰੋਪੜ ਵਿੱਚ ਵੀ ਕਈ ਗੁਰਦੁਆਰੇ ਹਨ ਜੋ ਇਤਿਹਾਸਿਕ ਘਟਨਾ ਨਾਲ ਸੰਬੰਧ ਰੱਖਦੇ ਹਨ ਉੱਥੇ ਆਰਕਿਲੋਜੀਕਲ ਮਿਊਜ਼ੀਅਮ ਵੀ ਹੈ ਅਤੇ ਸਰਹੰਦ ਕੈਨਾਲ ਵੀ ਹੈ ਜਿੱਥੇ ਕਿ ਵੋਟਿੰਗ ਕੀਤੀ ਜਾਂਦੀ ਹੈ ਚੰਡੀਗੜ੍ਹ ਵਿੱਚ ਬਹੁਤ ਮਸ਼ਹੂਰ ਥਾਵਾਂ ਹਨ ਜਿਵੇਂ ਕਿ ਰੋਜ਼ ਗਾਰਡਨ ਰੌਕ ਗਾਰਡਨ ਚਿੜੀਆ ਘਰ ਛੱਤਬੀੜ ਜ਼ੂ ਬਰਡ ਪਾਰਕ ਆਦਿ ਵੈਸੇ ਤਾਂ ਹਰ ਜਗ੍ਹਾ 'ਤੇ ਹਰ ਜ਼ਿਲ੍ਹੇ ਵਿੱਚ ਮੌਲ ਖੁੱਲ੍ਹ ਗਏ ਹਨ ਇਹਨਾਂ ਮੋਲਸ ਵਿੱਚ ਇੰਟਰਟੇਨਮੈਂਟ ਲਈ ਥੀਏਟਰ ਹੁੰਦੇ ਹਨ ਖਾਣਾ ਖਾਣ ਲਈ ਵੀ ਰੈਸਟੋਰੈਂਟ ਹੁੰਦੇ ਹਨ